ਦਸਤ ਦੇ ਇਲਾਜ ਲਈ ਸਭ ਤੋਂ ਪਹਿਲਾਂ ਨੁਸਖਾ ਚੀਨੀ ਨਮਕ ਦਾ ਘੋਲ ਚੀਨੀ ਨਮਕ ਅਤੇ ਪਾਣੀ ਨੂੰ ਬਰਾਬਰ ਮਾਤਰਾ 'ਚ ਲੈ ਲਓ ਅਤੇ ਦਸਤ ਪ੍ਰਭਾਵਿਤ ਵਿਅਕਤੀ ਨੂੰ ਥੋੜ੍ਹੀ ਥੋੜ੍ਹੀ ਦੇਰ ਨਾਲ ਉਸਦੇ ਸਰੀਰ ਦੀ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਏ ਦੂਜਾ ਨੁਸਖਾ ਨਿੰਬੂ ਦਾ ਰਸ ਇੱਕ ਕੱਪ ਪਾਣੀ 'ਚ ਨਿੰਬੂ ਦਾ ਰਸ ਮਿਲਾ ਲਓ ਅਤੇ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਦਸਤ ਪ੍ਰਭਾਵਿਤ ਵਿਅਕਤੀ ਨੂੰ ਦੇਣ ਨਾਲ ਉਸ ਦੀਆਂ ਅੰਤੜੀਆਂ ਸਾਫ ਹੋ ਜਾਂਦੀਆਂ ਨੇ ਤੀਜਾ ਨੁਸਖਾ ਜੀਰੇ ਦਾ ਪਾਣੀ ਇੱਕ ਲੀਟਰ ਪਾਣੀ 'ਚ ਇੱਕ ਚਮਚ ਜੀਰੇ ਨੂੰ ਉਬਾਲ ਕੇ ਫਿਰ ਠੰਡਾ ਕਰਕੇ ਰੱਖ ਲਓ ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਦੇਣ ਨਾਲ ਦਸਤ ਰੁਕ ਜਾਂਦੇ ਨੇ ਚੌਥਾ ਨੁਸਖਾ ਕੇਲਾ ਕੇਲੇ ਵਿੱਚ ਪੋਟਾਸ਼ੀਅਮ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਇਸ ਲਈ ਇਹ ਖਾਣ ਨਾਲ ਪੋਟਾਸ਼ੀਅਮ ਇਲੈਕਟ੍ਰੋਸਾਈਟਸ ਦੀ ਕਮੀ ਨੂੰ ਪੂਰਾ ਕਰੇਗਾ ਅਤੇ ਵਾਰ ਵਾਰ ਦਸਤ ਆਉਣੇ ਘੱਟ ਹੋ ਜਾਣਗੇ ਛੇਵਾਂ ਨੁਸਖਾ ਨਾਰੀਅਲ ਪਾਣੀ ਨਾਰੀਅਲ ਪਾਣੀ ਪੀਣ ਨਾਲ ਵੀ ਦਸਤ ਦੇ ਨਾਲ ਹੋਣ ਵਾਲੀ ਜਿਹੜੀ ਡਾਈਹੈਡਰੇਸ਼ਨ ਘੱਟ ਹੋ ਜਾਂਦੀ ਏ